ਬੈਂਕਾਂ ਤੋਂ ਇਲਾਵਾ ਲੋਕ ਪੈਸਾ ਕਢਾ ਲੈਂਦੇ ਨੇ ਜਿਵੇਂ ਏ ਟੀ ਐੱਮ ਹੈਗੇ ਨੇ ਚਲੋ ਉਹ ਵੀ ਕਈ ਵਾਰ ਬੈਂਕ ਦੇ ਨੇੜੇ ਹੁੰਦਾ ਪਰ ਬਿਨਾ ਬੈਂਕ ਤੋਂ ਵੀ ਪਰ ਅੱਜ ਕੱਲ੍ਹ ਨਾ ਇੱਕ ਚੱਲੇ ਨੇ ਕੁਛ ਜਿਹੜੇ ਸਰਵਿਸ ਦਿੰਦੇ ਨੇ ਅਤੇ ਉਹ ਕੀ ਹੈ ਤੁਸੀਂ ਆਪਣਾ ਏ ਟੀ ਐੱਮ ਲੈ ਜਾਉ ਜਾਂ ਆਪਣੇ ਬੈਂਕ 'ਚ ਪੈਸੇ ਜਮ੍ਹਾ ਕਰਵਾਉਣੇ ਨੇ ਉੱਥੇ ਲੈਣ ਦੇਣ ਕਰੀ ਜਾਂਦੇ ਨੇ ਬਸ ਥੋੜ੍ਹੇ ਜਿਹੇ ਫੀਸ ਚਾਰਜਿਸ ਲੈ ਲੈਂਦੇ ਨੇ ਪੈਸੇ ਕੱਟ ਲੈਂਦੇ ਨੇ ਠੀਕ ਹੈ ਬਾਕੀ ਪੈਟਰੋਲ ਪੰਪ ਵਗੈਰਾ 'ਤੇ ਵੀ ਮੈਂ ਦੇਖਿਆ ਮੈਂ ਆਪ ਵਰਤਿਆ ਕਿ ਥੋੜ੍ਹੇ ਉਹ ਪੈਸੇ ਤਾਂ ਲੈਂਦੇ ਨੇ ਅਤੇ ਅਗਰ ਤੁਹਾਨੂੰ ਕੈਸ਼ ਕਢਾਉਣਾ ਹੋਵੇ ਜਾਂ ਕੈਸ਼ ਜਮ੍ਹਾ ਕਰਾਉਣਾ ਹੋਵੇ ਤਾਂ ਕੈਸ਼ ਜਮ੍ਹਾ ਪੈਟਰੋਲ ਪੰਪ 'ਤੇ ਹੁੰਦਾ ਨਹੀਂ ਦੇਖਿਆ ਪਰ ਮੈਂ ਕਢਾਇਆ ਜ਼ਰੂਰ ਹੈ ਅਤੇ ਕਰਜ਼ਾ ਕੁਰਜ਼ਾ ਲੈਣ ਲਈ ਤਾਂ ਜ਼ਿਆਦਾਤਰ ਬੈਂਕ ਹੀ ਤਾਂ ਨਹੀਂ ਬੈਂਕਾਂ ਨਹੀਂ ਤਾਂ ਨਹੀਂ ਆੜ੍ਹਤੀਆਂ ਕੋਲ ਲੋਕ ਜਾਂਦੇ ਨੇ ਬਾਕੀ ਇਹ ਕਿ ਰਿਸ਼ਤੇਦਾਰ ਬਹੁਤ ਹ ਇੱਦਾਂ ਲੋਕਾਂ ਨੂੰ ਇੱਧਰੋਂ ਉੱਧਰੋਂ ਪੈਸਾ ਕਰਜ਼ੇ 'ਤੇ ਦਿਵਾ ਦਿੰਦੇ ਨੇ ਵਿਆਜ 'ਤੇ ਦਿਵਾ ਦਿੰਦੇ ਨੇ ਪਿੰਡਾਂ ਦੇ ਵਿੱਚ ਅਤੇ ਇਹੀ ਵਿਅਕਤੀਗਤ ਤੌਰ 'ਤੇ ਇਹ ਇੱਕ ਦੂਜੇ ਨੂੰ ਇਨਸਾਨ ਜਾਣਦਾ ਜਿਹੜੇ ਮੈਂ ਮੇਰੇ ਮੇਰੇ ਰਿਸ਼ਤੇਦਾਰੀ 'ਚ ਮੈਂ ਕਿਸੇ ਨੂੰ ਜਾਣਦਾ ਉਹ ਵੀ ਹਾਂ ਵੀ ਚੰਗੇ ਜ਼ਿਮੀਂਦਾਰ ਨੇ ਜਾਂ ਉਹਨਾਂ ਕੋਲ ਪੈਸਾ ਹੈਗਾ ਉਹਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਲੋੜਵੰਦ ਆ ਉਹਨਾਂ ਨੂੰ ਅੱਗੇ ਦਿਵਾ ਦਿੰਦੇ ਹਾਂ ਠੀਕ ਹੈ ਅਤੇ ਇਹ ਤਰੀਕੇ ਵਰਤੇ ਜਾਂਦੇ ਨੇ ਕੁਛ ਕਰਜ਼ਾ ਲੈਣ ਲਈ ਬੈਂਕਾਂ ਤੋਂ ਇਲਾਵਾ